ਹੈਲੋ ਤੁਸੀਂ ਡੋਕਟਰ ਅਰਸ਼ਦੀਪ ਕੌਰ ਬੋਲ ਰਹੇ ਹੋ ਸਤਿ ਸ਼੍ਰੀ ਅਕਾਲ ਡੋਕਟਰ ਮੈਂ ਮਨਜੋਤ ਬੋਲ ਰਹੀ ਹਾਂ ਹਾਂਜੀ ਮੈਂ ਠੀਕ ਹਾਂ ਐਕਚੁਲੀ ਪਿਛਲੇ ਥੋੜ੍ਹੇ ਟਾਈਮ ਤੋਂ ਨਾ ਮੇਰੀ ਬੈਕ ਪੇਨ ਕਾਫੀ ਜ਼ਿਆਦਾ ਹੀ ਵੱਧ ਗਈ ਆ ਬਹੁਤ ਹੀ ਕਰੋਨਿਕ ਹੋ ਗਈ ਆ ਤੁਹਾਨੂੰ ਪਤਾ ਹੀ ਹੋਉਂਗਾ ਕਿ ਮੈਂ ਤੁਹਾਡੇ ਤੋਂ ਬੈਕ ਪੇਨ ਦਾ ਟਰੀਟਮੈਂਟ ਲੈ ਰਹੀ ਹਾਂ ਹਾਂਜੀ ਉਹ ਫਿਰ ਨਾ ਕਾਫੀ ਜ਼ਿਆਦਾ ਹੀ ਵੱਧ ਗਈ ਆ ਕੰਮ ਵਗੈਰਾ ਨਹੀਂ ਹੋ ਰਿਹਾ ਬੌਡੀ ਕੰਮ ਹੀ ਨਹੀਂ ਕਰ ਰਹੀ ਬਿਲਕੁਲ ਵੀ

ਹਾਂ ਹਾਂਜੀ ਹਾਂਜੀ ਠੀਕ ਆ ਐਕਚੁਲੀ ਮੈਂ ਤੁਹਾਡੀਆਂ ਮੈਡੀਸਿਨਜ ਲੈ ਹੀ ਰਹੀ ਸੀਗੀ ਬਟ ਮੇ ਬੀ ਸ਼ਾਇਦ ਠੰਡ ਕਰਕੇ ਆ ਕਿ ਥੋੜ੍ਹਾ ਬਹੁਤ ਮਤਲਬ ਬੈਟਰ ਫੀਲ ਨਹੀਂ ਹੋ ਰਿਹਾ ਹਾਂਜੀ ਓਕੇ ਡੋਕਟਰ ਥੈਂਕ ਯੂ